ਪੰਜਾਬੀ ਭਾਸ਼ਾ ਦੀ ਤੁਲਨਾ ਹੋਰਨਾਂ ਭਾਸ਼ਾਵਾਂ ਨਾਲ ਕੀਤੀ ਜਾਂਦੀ ਹੈ ਜਿਵੇਂ ਕਿ ਹਿੰਦੀ ਹੋ ਗਈ ਉਰਦੂ ਹੋ ਗਈ ਹਰਿਆਣਵੀ ਹੋ ਗਈ ਹਿਮਾਚਲੀ ਭਾਸ਼ਾ ਹੋ ਗਈ ਇਹ ਭਾਸ਼ਾਵਾਂ ਜਿਹੜੀਆਂ ਨਾ ਸਾਰੀਆਂ ਹੀ ਸਾਡੀ ਭਾਸ਼ਾ ਪੰਜਾਬੀ ਦੇ ਨਾਲ ਮਿਲਦੀ ਜੁਲਦੀ ਆ ਇਹ ਭਾਸ਼ਾਵਾਂ ਬੋਲਣ ਵਿੱਚ ਬਹੁਤ ਆਸਾਨ ਹਨ ਇਹ ਭਾਸ਼ਾ ਸਾਡੀ ਪੰਜਾਬੀ ਭਾਸ਼ਾ ਦੇ ਵਿੱਚੋਂ ਹੀ ਇਹਨਾਂ ਦੇ ਕੁਛ ਸ਼ਬਦ ਮਿਲਦੇ ਜੁਲਦੇ ਹਨ ਜਿਸ ਤਰ੍ਹਾਂ ਇਹ ਹਿਮਾਚਲੀ ਹਿੰਦੀ ਉਰਦੂ ਹਰਿਆਣਵੀ ਭਾਸ਼ਾਵਾਂ ਜਿਹੜੀਆਂ ਵਾ ਇਹ ਉਹਨਾਂ ਦੇ ਇਲਾਕੇ ਵਿੱਚ ਬੋਲੀਆ ਜਾਂਦੀਆਂ ਹਨ ਜੋ ਕਿ ਸਾਡੇ ਹੀ ਪੰਜਾਬ ਵਿੱਚੋਂ ਨਿਕਲ ਕੇ ਗਏ ਹਨ ਇਸ ਕਰਕੇ ਸਾਡੀ ਪੰਜਾਬੀ ਭਾਸ਼ਾ ਦੀ ਸ਼ੋਅ ਜਿਹੜੀ ਆ ਇਹਨਾਂ ਭਾਸ਼ਾਵਾਂ ਵਿੱਚ ਬੋਲੀ ਜਾ ਮਿਲਦੀ ਆ ਹੁਣ ਇਹ ਆਧੁਨਿਕ ਯੁੱਗ ਵਿੱਚ ਵੀ ਸਾਡੀ ਭਾਸ਼ਾ ਜਿੱਦਾਂ ਪੰਜਾਬੀ ਹੈ ਇਹ ਅਲੋਪ ਹੋ ਰਹੀ ਆ ਸਾਨੂੰ ਆਪਣੀ ਪੰਜਾਬੀ ਭਾਸ਼ਾ ਨਾਲ ਪਿਆਰ ਕਰਨਾ ਚਾਹੀਦਾ ਜਿਵੇਂ ਹਰ ਉਹ ਹਰ ਇੱਕ ਆਪਣੇ ਭਾਸ਼ਾ ਨਾਲ ਪਿਆਰ ਕਰਦਾ ਸਾਨੂੰ ਵੀ ਆਪਣੀ ਭਾਸ਼ਾ ਨਾਲ ਪਿਆਰ ਕਰਨਾ ਚਾਹੀਦਾ ਹੈ